ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਉੱਥੇ ਬੋਲਦੀ ਹਾਂ ਜੀ ਤੁਸੀਂ ਦੱਸੋ ਜੀ ਕਿਵੇਂ ਹੋ ਠੀਕ ਹੋ ਹਾਂਜੀ ਆਓ ਜੀ ਜੀ ਆਇਆਂ ਨੂੰ ਹਾਂਜੀ ਬਹੁਤ ਵਧੀਆ ਸ਼ੂਜ਼ ਮਿਲਦੇ ਨੇ ਬਹੁਤ ਵਧੀਆ ਕੰਪਨੀਆਂ ਜੀ ਸਾਡੇ ਸ਼ੂ ਸ਼ੂਜ਼ ਵਾਲੀ ਕੰਪਨੀ ਅਤੇ ਜਿਹਦੇ ਹਰ ਬਹੁਤ ਕਈ ਲੋਕ ਆਉਂਦੇ ਨੇ ਕਈ ਲੋਕ ਜਾਂਦੇ ਨੇ ਸਾਡੇ ਕੰਪਨੀ ਤੋਂ ਸਮਾਨ ਲੈ ਕੇ ਜਾਂਦੇ ਨੇ ਸ਼ੂਜ਼ ਵਗੈਰਾ ਲੇਡੀਜ ਦੇ ਜੈਂਟਸ ਦੇ ਸਭ ਸ਼ੂਜ਼ ਮਿਲਦੇ ਨੇ ਤੁਸੀਂ ਆਓ ਜੀ ਜ਼ਰੂਰ ਆਓ ਜੀ ਹਾਂਜੀ ਫੋਰਮਲੀ ਸ਼ੂਜ਼ ਵੀ ਮਿਲਦੇ ਨੇ ਜੀ ਹਾਂਜੀ ਹਾਂਜੀ ਹਾਂਜੀ ਆਓ ਜੀ ਜ਼ਰੂਰ ਆਓ ਜੀ ਤੁਹਾਡੇ ਨਾਲ ਹੋਰ ਨੂੰ ਵੀ ਲੈ ਕੇ ਆਓ ਦੱਸ ਪਾਓ ਵਧੀਆ ਗੱਲ ਹੈ ਜੀ ਸਾਡੀ ਦੁਕਾਨ ਬਹੁਤ ਵਧੀਆ ਮਸ਼ਹੂਰ ਦੁਕਾਨ ਹੈ ਜੀ ਸ਼ੂਜ਼ ਦੀ ਦੁਕਾਨ ਜੀ ਬਰਨਾਲੇ ਸਦਰ ਬਾਜ਼ਾਰ ਵਿੱਚ ਹੈ ਦੁਕਾਨ ਤੁਸੀਂ ਉੱਥੋਂ ਕਿਸੇ ਨੂੰ ਪੁੱਛ ਸਕਦੇ ਹੋ ਵੀ ਸ਼ੂਜ਼ ਦੇ ਕੰਚਨ ਸ਼ੂਜ ਹਾਊਸ ਕਿੱਥੇ ਹੈ ਜੀ ਤੁਹਾਨੂੰ ਸਾਰੇ ਦੱਸ ਦੇਣਗੇ ਅਤੇ ਤੁਹਾਨੂੰ ਤੇ ਆਪੇ ਲੈ ਆਉਣਗੇ ਜੀ ਉੱਥੇ ਹਾਂਜੀ ਹਾਂਜੀ ਬਰਨਾਲੇ ਸਦਰ ਬਾਜ਼ਾਰ ਦੇ ਸਾਹਮਣੇ ਵਾਲੀ ਦੁਕਾਨ ਹੈ ਵੱਡੀ ਜੀ ਹਾਂਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ